ਰੇਲ ਗੱਡੀ ਵਿੱਚ ਮੈਂ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੱਕ ਅਕਸਰ ਹੀ ਸਫਰ ਕਰਦੀ ਹਾਂ ਇਸ ਦੇ ਰਸਤੇ ਵਿੱਚ ਲਾਧੂ ਕਾ ਜਲਾਲਾਬਾਦ ਗੁਰੂ ਹਰਸਹਾਏ ਪੰਜੇ ਕੀ ਖਾਈ ਫੈਮੀ ਕੀ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਸ਼ਹਿਰ ਆਉਂਦਾ ਹੈ ਰੇਲ ਗੱਡੀ ਵਿੱਚ ਜਿਹੜੀਆਂ ਸੀਟਾਂ ਦਾ ਕਈ ਵਾਰੀ ਕੱਪੜਾ ਵੀ ਫਟਿਆ ਹੁੰਦਾ ਹੈ ਅਤੇ ਮਾੜੀ ਹਾਲਤ ਹੋਣ ਕਰਕੇ ਬੈਠਣਾ ਵੀ ਔਖਾ ਹੋ ਜਾਂਦਾ ਹੈ ਡੀਜ਼ਲ ਇੰਜਣ ਹੋਣ ਕਰਕੇ ਖੜ੍ਹੀ ਆਵਾਜ਼ ਹੁੰਦੀ ਹੈ ਬਾਥਰੂਮ ਦੀ ਹਾਲਤ ਖਸਤਾ ਹੁੰਦੀ ਹੈ ਕਈ ਵਾਰੀ ਇਹਨਾਂ ਵਿੱਚ ਪਾਣੀ ਵੀ ਨਹੀਂ ਹੁੰਦਾ ਬਾਥਰੂਮ ਨੂੰ ਵਰਤਣ ਤੋਂ ਬਾਅਦ ਇਸ ਵਿੱਚ ਬਹੁਤ ਜ਼ਿਆਦਾ ਸਮੈਲ ਆਉਂਦੀ ਹੈ ਰੇਲਵੇ ਟਰੈਕ ਜਿਹੜਾ ਸਾਨੂੰ ਹੁਣ ਬਿਜਲੀ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਸਮੇਂ ਦੀ ਬੱਚਤ ਹੋ ਸਕੇ